ਬਾਈ ਨਵੰਬਰ ਦੋ ਹਜ਼ਾਰ ਤਿੰਨ ਦਸ ਅਕਤੂਬਰ ਦੋ ਹਜ਼ਾਰ ਪੰਜ ਸੱਤ ਅਪ੍ਰੈਲ ਦੋ ਹਜ਼ਾਰ ਪੰਜ ਚਾਰ ਅਗਸਤ ਦੋ ਹਜ਼ਾਰ ਸੱਤ ਉੱਨੀ ਜੁਲਾਈ ਦੋ ਹਜ਼ਾਰ ਵੀਹ